ਬਹੁਤ ਸਾਰੀਆਂ ਸ਼ੈਲੀਆਂ ਹੈ ਜਿਹੜਾ ਜਿਹਨਾਂ 'ਚ ਆਪਾਂ ਸਿੱਖਣਾ ਚਾਹੁੰਦੇ ਹਾਂ ਉਹਨਾਂ ਵਿੱਚ ਮੇਨ ਇਹ ਹੈ ਹੁਣ ਜਿਹੜੀ ਹੱਥਾਂ ਦੀ ਕਢਾਈ ਬੁਣਾਈ ਹੈ ਉਹ ਹੌਲੀ ਹੌਲੀ ਤਕਨੀਕ ਬੰਦ ਹੋਈ ਜਾਂਦੀ ਆ ਹੁਣ ਆਪਣੇ ਲੁਧਿਆਣੇ ਦੇਖ ਲਓ ਮਸ਼ੀਨਾਂ ਕਿੰਨੀਆਂ ਚੱਲ ਪਈਆਂ ਹੱਥਾਂ ਵਾਲਾ ਤਾਂ ਕੰਮ ਬੰਦ ਕਰਦਾ ਉਹਨਾਂ ਨੇ ਉਹ ਮਸ਼ੀਨਾਂ ਹੀ ਆ ਗਈਆਂ ਜਿਹੜੇ ਜਿੱਥੇ ਵੀ ਬੁਣਦੇ ਕੋਟੀ ਸਵੈਟਰ ਫੈਕਟਰੀਆਂ ਬੜੀ ਬੜੀਆਂ ਲੱਗ ਗਈਆਂ ਉੱਥੇ ਫੈਕਟਰੀਆਂ ਬੜੀਆਂ ਬੜੀਆਂ ਲੱਗ ਗਈਆਂ ਉੱਥੇ ਇਹ ਆਪਣੇ ਮਸ਼ੀਨਾਂ ਨਾਲ ਸਿਲਾਈ ਕਢਾਈ ਕਰਦੇ ਹੈ ਉਸ ਦਾ ਉਹ ਕੱਪੜਿਆਂ ਦਾ ਕੁਆਲਿਟੀ ਨਹੀਂ ਹੁੰਦੀ ਨਾ ਗਰਮ ਵੀ ਨਹੀਂ ਹੁੰਦੇ ਜਿਹੜੀ ਆਪਾਂ ਹੱਥਾਂ ਨਾਲ ਬੁਣਦੇ ਹੈ ਨਾ ਇਹ ਹੱਥਾਂ ਨਾਲ ਬੁਣਨਾ ਜਿਹੜਾ ਜਿਹੜੀ ਹੱਥ ਨਾਲ ਬੁਣਦੇ ਆ ਉਹ ਗਰਮ ਵੀ ਹੁੰਦੀ ਹੈ ਅਤੇ ਇਹਦੀ ਕੁਆਲਿਟੀ ਹੁੰਦੀ ਹੈ ਜਿਹੜੀ ਹੁਣ ਮਸ਼ੀਨਾਂ ਵਾਲੀਆਂ ਗਈਆਂ ਉਹਦੀ ਕੁਆਲਿਟੀ ਨਹੀਂ ਹੁੰਦੀ ਕੱਪੜੇ ਦੀ ਬਿਲਕੁਲ ਕੁਆਲਿਟੀ ਨਹੀਂ ਹੈਗੀ ਡੈਡ ਕੁਆਲਿਟੀ ਆ ਉਹਨਾਂ ਦੀ ਜਿਹੜੀ ਹੱਥਾਂ ਨਾਲ ਬੁਣ ਬੁਣਦੇ ਹਾਂ ਨਾ ਉਹਦੀ ਇੱਕ ਇੱਕ ਨੰਬਰ ਕੁਆਲਟੀ ਹੈ ਉਹਦੀ ਐਨ ਪੂਰੀ